ਦਸ ਇੱਕ ਸੌ ਵੀਹ ਦੋ ਸੌ ਪੰਜਾਹ ਚਾਰ ਸੌ ਨੱਬੇ ਛੇ ਸੌ ਅੱਸੀ ਸੱਤ ਸੌ ਵੀਹ ਦੋ ਹਜ਼ਾਰ ਪੰਜ ਪੰਜ ਸੌ ਛੇ ਆਦਿ